ਬਰਤਨ ਧੋਣ ਦੀ ਪ੍ਰਕਿਰਿਆ ਬਾਰੇ ਦੱਸਣ ਲਈ ਮੈਂ ਤਿਆਰ ਹਾਂ ਸਭ ਤੋਂ ਪਹਿਲਾਂ ਇਸ ਵਿੱਚ ਸਾਬਣ ਜਾਂ ਬਰਤਨ ਧੋਣ ਵਾਲਾ ਲਿਕੁਡ ਪਾਊਡਰ ਵਰਦੇ ਕਿਸੇ ਕਲੀਨਿੰਗ ਏਜੰਟ ਦੀ ਵਰਤੋਂ ਕਰਦੇ ਹੋਏ ਬਰਤਨਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਰਗੜਿਆ ਜਾਂਦਾ ਹੈ ਇਸ ਤੋਂ ਬਾਅਦ ਬਰਤਨ ਨੂੰ ਚੰਗੀ ਤਰ੍ਹਾਂ ਧੋਤਾ ਜਾਂਦਾ ਹੈ ਤਾਂ ਜੋ ਸਾਰਾ ਸਾਬਣ ਉਤਰ ਜਾਵੇ ਤੇਲ ਵਾਲੇ ਬਰਤਨਾਂ ਨੂੰ ਸਾਫ ਕਰਨ ਲਈ ਮੈਨ ਗਰਮ ਪਾਣੀ ਅਤੇ

ਪਾਣੀ ਅਤੇ ਬਰਤਨ ਧੋਣ ਵਾਲੇ ਸਾਬਣ ਦੀ ਵਰਤੋਂ ਕਰਦਾ ਹਾਂ ਮੈਂ ਬਰਤਨ ਧੋਣ ਵਾਲੇ ਸਪੋਂਜ ਜਾਂ ਬੁਰਸ਼ ਦੀ ਵਰਤੋਂ ਤਰਦਾ ਹਾਂ ਤਾਂ ਜੋ ਸਾਰਾ ਤੇਲ ਅਤੇ ਥਾਨਾ ਉੱਤਰ ਜਾਵੇ ਜੇ ਬਰਤਨ ਬਹੁਤ ਗੰਦੇ ਹੋਣ ਤਾਂ ਮੈਂ ਉਹਨਾਂ ਨੂੰ ਥੋੜ੍ਹੇ ਸਮੇਂ ਲਈ ਗਰਮ ਪਾਣੀ ਅਤੇ ਸਾਬਣ ਵਾਲੀ ਘੋਲ ਵਿੱਚ ਪਿਓਂ ਕੇ ਰੱਖਦਾ ਹਾਂ